ਹਾਂਜੀ ਜਦੋਂ ਮੇਰੇ ਕੋਲ ਸਿਲਾਈ ਮਸ਼ੀਨ ਮੋਦੀ ਕੰਪਨੀ ਦੀ ਹੈ ਜਿਹੜੀ ਬਹੁਤ ਵਧੀਆ ਚੱਲਦੀ ਹੈ ਅਤੇ ਮੈਨੂੰ ਪਹਿਲੀ ਵਾਰ ਚੁਣੌਤੀਆਂ ਦਾ ਸਾਹਮਣਾ ਇਹ ਕਰਨਾ ਪਿਆ ਕਿ ਮੇਰੇ ਕੋਲ ਧਾਗਾ ਨੀਚੋ ਬਾਰ ਬਾਰ ਟੁੱਟ ਜਾਂਦਾ ਸੀਗਾ ਨੀਚੋ ਸਿਲਾਈ ਖਰਾਬ ਹੋ ਜਾਂਦੀ ਸੀਗੀ ਅਤੇ ਇਹ ਮੈਨੂੰ ਪਰੇਸ਼ਾਨੀਆਂ ਬਹੁਤ ਆਈਆਂ ਇਸ ਕਰਕੇ ਪਰ ਹੁਣ ਸ ਹੁਣ ਮੈਨੂੰ ਸਹੀ ਹੋ ਗਿਆ ਸਾਰਾ ਕੁਛ ਹੁਣ ਮੈਂ ਕਰ ਲੈਨੀ ਹਾਂ ਸਾਰੇ ਸਿਲਾਈ ਵਧੀਆ